ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਮੈਨੂੰ ਲੱਗਦਾ ਏ ਕਿ ਵੱਧ ਤੋਂ ਵੱਧ ਪੇੜ ਪੌਦੇੇ ਲਗਾਉਣੇ ਚਾਹੀਦੇ ਹਨ ਸਿਰਫ ਲਗਾਉਣਾ ਹੀ ਨਹੀਂ ਉਹਨਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਉਹਨਾਂ ਨੂੰ ਟਾਈਮ ਟੂ ਟਾਈਮ ਪਾਣੀ ਅਤੇ ਖਾਦ ਪਾਓ ਜਿਹਦੇ ਨਾਲ ਕੀ ਆ ਸਾਡਾ ਵਾਤਾਵਰਨ ਸਾਫ ਸੁਥਰਾ ਰਵੇ ਅਤੇ ਹਰਿਆ ਭਰਿਆ ਰਵੇ ਸੋ ਮੇਰੇ ਨੇੜੇ ਹੀ ਕੀ ਹੈ ਇੱਕ ਬਾਰਾਦਰੀ ਗਾਰਡਨ ਪਾਇਆ ਜਾਂਦਾ ਹੈ ਸੋ ਜਿੱਥੇ ਕੀ ਆ ਕਾਫੀ ਜ਼ਿਆਦਾ ਹਰਿਆਲੀ ਪਾਈ ਜਾਂਦੀ ਔਰ ਉੱਥੇ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਜੋ ਲੋਕ ਉੱਥੇ ਘੁੰਮਣ ਆਉਂਦੇ ਹਨ ਸੈਰ ਸਪਾਟਾ ਕਰਨ ਆਉਂਦੇ ਆ ਸੋ ਇੱਥੋਂ ਦੀ ਹਰਿਆਲੀ ਮੇਰੇ ਸ਼ਹਿਰ ਦੇ ਲੋਕਾਂ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕਰਦੀ ਆ ਅਤੇ ਉਹ ਸਵੇਰ ਦੀ ਸੈਰ ਅਤੇ ਸ਼ਾਮ ਦੀ ਸੈਰ ਇਸੇ ਗਾਰਡਨ ਦੇ ਵਿੱਚ ਕਰਨਾ ਪਸੰਦ ਕਰਦੇ ਹੈ